ਘੁੰਮਣਾ ਹਰ ਮਨੁੱਖ ਨੂੰ ਪਸੰਦ ਹੈ ਉਸ ਹੈ ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ ਨੇ ਜਿਸ 'ਤੇ ਅਸੀਂ ਘੁੰਮ ਕੇ ਅਨੰਦ ਲੈ ਸਕਦੇ ਹਾਂ ਮੈਂ ਅਤੇ ਮੇਰੇ ਫਰੈਂਡਸ ਨੇ ਵੀ ਘੁੰਮਣ ਦਾ ਪਲੈਨ ਬਣਾਇਆ ਅਸੀਂ ਸ਼ਿਮਲਾ ਘੁੰਮਣ ਲਈ ਗਏ ਉੱਥੇ ਅਸੀਂ ਸ਼ਿਮਲੇ ਸ਼ਿਮਲੇ ਜਾਣ ਲਈ ਅਸੀਂ ਬੱਸ ਅਸੀਂ ਬੱਸ ਬੱਸ 'ਤੇ ਸ਼ਿਮਲਾ ਘੁੰਮਣ ਗਏ ਅਤੇ ਅਸੀਂ ਆਪਣੇ ਨਾਲ ਆਪਣਾ ਲੋੜੀਂਦਾ ਸਮਾਨ ਲੈ ਕੇ ਸ਼ ਕਿਤੇ ਵੀ ਆਪਾਂ ਘੁੰਮਣ ਜਾਈਏ ਉਹਦੇ ਲਈ ਆਪਾਂ ਨੂੰ ਜ਼ਿਆਦਾ ਭਾਰੀ ਸਮਾਨ ਨਹੀਂ ਲਿਜਾਣਾ ਚਾਹੀਦਾ ਹਲਕਾ ਖਾਣ ਵਾਲਾ ਹਲਕੀਆਂ ਚੀਜ਼ਾਂ ਲਿਜਾਣੀਆਂ ਚਾਹੀਦੀਆਂ ਹਨ ਜਿਵੇਂ ਕਿ ਕੁਛ ਨਮਕੀਨਸ ਵਗੈਰਾ ਜਾਂ ਹਲਕੇ ਫੁਲਕੇ ਖਾਣਾ ਹੀ ਖਾਣਾ ਚਾਹੀਦਾ ਹੈ ਨਾਲ ਲਿਜਾਣਾ ਚਾਹੀਦਾ ਹੈ ਤਾਂ ਜੋ ਆਪਾਂ ਨੂੰ ਰਸਤੇ ਵਿੱਚ ਕੋਈ ਵੀ ਜਿਹੜੀ ਆ ਅ ਪ੍ਰੋਬਲਮ ਨਾ ਆਵੇ ਇਸ ਤਰ੍ਹਾਂ ਹੀ ਪੀਣ ਵਿੱਚ ਵੀ ਪਾਣੀ ਜ਼ਰੂਰ ਲਿਜਾਣਾ ਚਾਹੀਦਾ ਹੈ ਇਸ ਤਰ੍ਹਾਂ ਹੋਰ ਅਸੀਂ ਕਾਫੀ ਸਾਰੀਆਂ ਡਰਿੰਕਸ ਵੀ ਲੈ ਗਏ ਨਾਲ ਇਸ ਤਰ੍ਹਾਂ ਅਸੀਂ ਆਪਾਂ ਖੂਬ ਇੰਜੋਏ ਕੀਤਾ ਹਰ ਹਰ ਇੱਕ ਨੂੰ ਘੁੰਮਣਾ ਚਾਹੀਦਾ ਹੈ ਤਾਂ ਜੋ ਆਪਣੀ ਜ਼ਿੰਦਗੀ ਦਾ ਅਨੰਦ ਲੈ ਸਕੇ